ਹਾਂਜੀ ਸਿਲਾਈ ਕਰਦੇ ਹੋਏ ਕਈ ਵਾਰ ਮੇਰੇ ਤੋਂ ਅਜਿਹੇ ਪ੍ਰੋਜੈਕਟ ਖਰਾਬ ਹੋਏ ਹਨ ਕਿ ਸਿਲਾਈ ਕਰਦੇ ਸਮੇਂ ਮੈਨੂੰ ਬਹੁਤ ਵੱਡੀਆਂ ਸਮੱਸਿਆ ਆਉਂਦੀ ਸੀ ਕਟਾਈ ਦੇ ਵਿੱਚ ਅਤੇ ਮੈਂ ਇਹ ਹਮੇਸ਼ਾ ਕਟਾਈ ਆਪਣੇ ਅਧਿਆਪਕ ਸਾਹਿਬਾਨ ਦੀ ਮੌਜੂਦਗੀ ਦੇ ਵਿੱਚ ਕਰਦੀ ਸੀ ਪਰ ਇੱਕ ਵਾਰ ਜਦੋਂ ਮੈਂ ਕਟਾਈ ਕਰਦੀ ਸੀ ਉਸ ਟ ਟਾਈਮ 'ਤੇ ਮੇਰੇ ਅਧਿਆਪਕ ਸਾਹਿਬਾਨ ਮੇਰੇ ਨਾਲ ਨਹੀਂ ਸਨ ਅਤੇ ਜਿਸ ਕਰਕੇ ਮੇਰੀ ਉਹ ਕਟਾਈ ਖਰਾਬ ਹੋ ਗਈ ਅਤੇ ਉਹਦੇ ਨਾਲ ਪੂਰਾ ਸਿਰਹਾਣੇ ਦਾ ਕਵਰ ਵੀ ਖਰਾਬ ਹੋ ਗਿਆ ਅਤੇ ਮੇਰਾ ਕੱਪੜਾ ਵੀ ਖਰਾਬ ਹੋ ਗਿਆ ਮੈਨੂੰ ਉਹ ਯਾਦ ਹੈ ਅਤੇ ਦੂਸਰੇ ਦਿਨ ਮੈਂ ਆਪਣੇ ਅਧਿਆਪਕ ਸਾਹਿਬਾਨ ਨੂੰ ਪੂਰੀ ਵਾਰਦਾਤ ਬਾਰੇ ਦੱਸਿਆ ਅਤੇ ਉਨ੍ਹਾਂ ਨੇ ਮੈਨੂੰ ਦੱਸਿਆ ਕਿ ਮੈਂ ਇਹ ਕਟਾਈ ਪੁੱਠੀ ਕੀਤੀ ਸੀ ਮਤਲਬ ਗਲਤ ਕੀਤੀ ਸੀ ਜਿਸ ਕਰਕੇ ਮੇਰਾ ਕੱਪੜਾ ਵੀ ਖਰਾਬ ਹੋ ਗਿਆ